ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਲੰਮੀ ਦੂਰੀ ਦੀ ਦੌੜ ਦੇ ਵਿੱਚ ਹਿੱਸਾ ਲਿਆ ਹੈ ਮੈ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਮੈਂ ਇੰਡੀਅਨ ਆਰਮੀ ਦੀ ਤਿਆਰੀ ਕਰਦਾ ਸੀ ਫਿਜੀਕਲ ਤੌਰ 'ਤੇ ਤਾਂ ਉਸ ਟਾਈਮ ਅਸੀਂ ਰੋਜ਼ਾਨਾ ਗਰਾਊਂਡ ਜਾਂਦੇ ਗਰਾਉਂਡ ਮੈਂ ਹੁਣ ਵੀ ਜਾਂਦਾ ਬਟ ਜਦੋਂ ਉਦੋਂ ਅਸੀਂ ਗਰਾਉਂਡ ਜਾਂਦੇ ਤਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਮੈਂ ਥੋੜ੍ਹੀ ਰਨਿੰਗ ਮੰਨ ਲਓ ਆਪਾਂ ਕਹਿ ਦਈਏ ਵੀ ਸੋਲ੍ਹਾਂ ਸੌ ਕਿਲੋਮੀਟਰ ਸੋਲ੍ਹਾਂ ਸੌ ਕਿਲੋਮੀਟਰ ਤਾਂ ਨਹੀਂ ਬਟ ਸੋਲ੍ਹਾਂ ਸੌ ਮੀਟਰ ਅਸੀਂ ਜਿਹੜੀ ਹੈਗੀ ਡੇਲੀ ਸਾਡਾ ਇੱਕ ਟਾਰਗੇਟ ਹੁੰਦਾ ਸੀ ਵੀ ਇੰਨੀ ਅਸੀਂ ਦੌੜ ਲਗਾਉਣੀ ਹੀ ਹੈ ਸੋਲ੍ਹਾਂ ਸੌ ਮੀਟਰ ਅਸੀਂ ਡੇਲੀ ਦੌੜ ਲਗਾਉਂਦੇ ਅਤੇ ਨਾਲ ਨਾਲ ਆ ਕੇ ਅਸੀਂ ਐ ਐਕਸਰਸਾਈਜ਼ ਕਰਦੇ ਸਰੀਰ ਨੂੰ ਇਸ ਤੋਂ ਬਾਅਦ ਠੰਢਾ ਹੋ ਕੇ ਸਰੀਰ ਨੂੰ ਅਸੀਂ ਪ੍ਰੋਪਰ ਇੱਕ ਨੋਰਮਸ ਸਥਿਤੀ ਦੇ ਵਿੱਚ ਰੱਖਣ ਦੇ ਵਾਸਤੇ ਵੀ ਅਸੀਂ ਕੁਝ ਐਕਸਰਸਾਈਜ਼ ਜਿਹੜੀਆਂ ਹੈਗੀਆਂ ਅਸੀਂ ਉਹ ਕਰਦੇ ਸੀਗੇ ਪਰ ਅਸੀਂ ਹਫਤੇ ਦੇ ਵਿੱਚ ਇੱਕ ਵਾਰ ਅਸੀਂ ਲੰਮੀ ਦੌੜ ਯਾਨੀ ਕਿ ਪੰਜ ਕਿਲੋਮੀਟਰ ਅਸੀਂ ਹਫਤੇ ਵਿੱਚ ਇੱਕ ਵਾਰ ਜ਼ਰੂਰ ਲਗਾਉਂਦੇ ਸੀ ਉਸ ਨਾਲ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲਦਾ ਸੀ ਉਸ ਨਾਲ ਕੀ ਸੀ ਕਿ ਸਾਡਾ ਜੋ ਹੈ ਦਮ ਪੱਕ ਜਾਂਦਾ ਸੀਗਾ ਜਿਹਦੇ ਨਾਲ ਸਾਡੀ ਕਹਿੰਦੇ ਕੀ ਸੀਗਾ ਸਾਡੀ ਦੌੜ ਹੋਰ ਜ਼ਿਆਦਾ ਜਿਹੜੀ ਹੈਗੀ ਸੀ ਉਹ ਇਮਪਰੂਵ ਹੁੰਦੀ ਸੀ ਜਦੋਂ ਅਸੀਂ ਆਰਮੀ ਦੀ ਤਿਆਰੀ ਕਰਦੇ ਤਾਂ ਸ਼ੁਰੂਆਤੀ ਦਿਨਾਂ ਵਿੱਚ ਮੇਰਾ ਟਾਈਮ ਯਾਨੀ ਕਿ ਜਿੱਦਾਂ ਆਰਮੀ ਦੇ ਵਿੱਚ ਸੋਲ੍ਹਾਂ ਸੌ ਮੀਟਰ ਦੀ ਜਿਹੜੀ ਹੈਗੀ ਆ ਉਹ ਦੌੜ ਲਗਾਉਣੀ ਹੁੰਦੀ ਆ ਉਹਦੇ ਵਾਸਤੇ ਪੰਜ ਮਿੰਟ ਅਤੇ ਪੰਤਾਲੀ ਸਕਿੰਤ ਦਾ ਉੱਥੇ ਟਾਈਮ ਦਿੰਦੇ ਹੈ ਤਾਂ ਉਹਦੇ ਦੌੜ ਦੇ ਲਈ ਜਿਹੜੀ ਸਾਡੀ ਲੰਮੀ ਰਨਿੰਗ ਹੈ ਲੰਮੀ ਦੌੜ ਹੈ ਉਹ ਬਹੁਤ ਬੈਨੀਫਿਟ ਸਿੱਧ ਹੁੰਦੀ ਸੀ ਉਸ ਟਾਈਮ ਅਸੀਂ ਜਦੋਂ ਹਫਤੇ ਵਿੱਚ ਇੱਕ ਦਿਨ ਲੰਮੀ ਦੌੜ ਲਗਾਉਂਦੇ ਪੰਜ ਕਿਲੋਮੀਟਰ ਜਾਂਦੇ ਤਾਂ ਉਹਦੇ ਨਾਲ ਸਾਡਾ ਸਟੈਮੀਨਾ ਵਧਦਾ ਯਾਨੀ ਕਿ ਜਦੋਂ ਅਸੀਂ ਭੱਜਦੇ ਤਾਂ ਸਾਡੀ ਪਹਿਲਾਂ ਸ਼ੁਰੂਆਤੀ ਦਿਨਾਂ ਵਿੱਚ ਸਾਡੀ ਵੱਖੀ ਭੱਜ ਜਾਂਦੀ ਸੀ ਸਾਡਾ ਭੱਜਣ ਨੂੰ ਜੀਅ ਨਹੀਂ ਕਰਦਾ ਸੀ ਅਤੇ ਸਾਡਾ ਸਾਹ ਫੁੱਲਣ ਲੱਗ ਜਾਂਦਾ ਸੀ ਸਾਡਾ ਦਮ ਚੜ੍ਹ ਜਾਂਦਾ ਸੀ ਅਸੀਂ ਰੁਕ ਜਾਂਦੇ ਸੀ ਰਸਤੇ 'ਚ ਬਟ ਜਦੋਂ ਅਸੀਂ ਹਫਤੇ ਦੇ ਵਿੱਚ ਇੱਕ ਦਿਨ ਲੰਮੀ ਦੌੜ ਲਗਾਉਣ ਲੱਗ ਗਏ ਤਾਂ ਜਦੋਂ ਅਸੀਂ ਲੰਮੇ ਦੌੜਦੇ ਜਾਂਦੇ ਉਹਦੇ ਨਾਲ ਸਾਡਾ ਸਟੈਮੀਨਾ ਬਣੀ ਗਿਆ ਸਾਡਾ ਜਿਹੜਾ ਹੈਗਾ ਸੀਗਾ ਦਮ ਪੱਕ ਗਿਆ ਯਾਨੀ ਕਿ ਸਾਨੂੰ ਜ਼ਿਆਦਾ ਲੰਮਾ ਭੱਜਣ ਦੇ ਕਾਰਨ ਕਹਿੰਦੇ ਸਾਨੂੰ ਕੀ ਆ ਹੁਣ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ ਸੀ ਅਸੀਂ ਆਰਾਮ ਦੇ ਨਾਲ ਸੋਲ੍ਹਾਂ ਸੌ ਮੀਟਰ ਜਿਹੜੀ ਹੈਗੀ ਸੀ ਦੌੜ ਉਹ ਆਰਾਮ ਨਾਲ ਅਸੀਂ ਲਗਾ ਦਿੰਦੇ ਸੀ ਸਾਡੀ ਕੋਈ ਵੀ ਵੱਖੀ ਨਹੀਂ ਭਰਦੀ ਸੀ ਸਾਡਾ ਕੋਈ ਵੀ ਸਾਹ ਨਹੀਂ ਫੁਲਦਾ ਸੀ ਇਸ ਲਈ ਸਾਨੂੰ ਲੰਮੀ ਵੈਨ ਦੌੜ ਦਾ ਬਹੁਤ ਬੈਨੀਫਿਟ ਮਿਲਿਆ ਜਿਸ ਨਾਲ ਕਿ ਆ ਸਾਡਾ ਦਮ ਪੱਕ ਗਿਆ ਸੋ ਮੈ ਆਪਣਾ ਇਹ ਥੋੜ੍ਹਾ ਜਿਹਾ ਜਿਹੜਾ ਐਕਸਪੀਰੀਅੰਸ ਸੀ ਆਪ ਜੀ ਨਾਲ ਮੈਂ ਸ਼ੇਅਰ ਕੀਤਾ ਕਿ ਮੈਂ ਜਿਹੜੀ ਹੈਗੀ ਆ ਲੰਮੀ ਦੌੜ ਆਪਣੀ ਜ਼ਿੰਦਗੀ ਦੇ ਵਿੱਚ ਲਗਾਈ ਹੈ ਅਤੇ ਜ਼ਰੂਰ ਸਾਨੂੰ ਹੈਗੀ ਐ ਜਿਹੜੀ ਹਫਤੇ ਵਿੱਚੋਂ ਜਾਂ ਦੋ ਹਫਤੇ ਵਿੱਚੋਂ ਜਾਂ ਮਹੀਨੇ ਵਿੱਚ ਦੋ ਵਾਰ ਸਾਨੂੰ ਲੰਮੀ ਦੌੜ ਜ਼ਰੂਰ ਜਿਹੜੀ ਹੈਗੀ ਆ ਸਾਨੂੰ ਲਗਾਉਣੀ ਚਾਹੀਦੀ ਹੈ ਇਹ ਮੇਰਾ ਆਪ ਦਾ ਖੁਦ ਦਾ ਐਕਸਪੀਰੀਅੰਸ ਰਿਹਾ ਹੈਗਾ ਕਿ ਮੈਨੂੰ ਉਹਦੇ ਨਾਲ ਕੀ ਹੈ ਮੇਰੇ ਸਰੀਰ ਦੇ ਵਿੱਚ ਮੈਨੂੰ ਬਹੁਤ ਇਮਪਰੂਵਮੈਂਟ ਜਿਹੜੀ ਹੈਗੀ ਆ ਉਹ ਮੈਨੂੰ ਆਪਣੇ ਆਪ ਨੂੰ ਮਹਿਸੂਸ ਹੋਈ ਕਿ ਮੇਰੀ ਰਨਿੰਗ ਦੇ ਵਿੱਚ ਵੀ ਇਹਨੇ ਬਹੁਤ ਜ਼ਿਆਦਾ ਜਿਹੜਾ ਹੈਗਾ ਇਫੈਕਟ ਪਾਇਆ ਹੈਗਾ ਅਤੇ ਜਿਹਦੇ ਨਾਲ ਮੇਰੀ ਹੈਗੀ ਸੀ ਅੱਗੇ ਨੂੰ ਮੇਰੀ ਰੇਸ ਵੀ ਥੋੜ੍ਹੀ ਹੈਗੀ ਸੀ ਜ਼ਿਆਦਾ ਵੱਧ ਗਈ ਸੀ ਸੋ ਇਹ ਮੈਂ ਐਂਡ ਉੱਤੇ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਲੰਮੀ ਦੌੜ ਲਗਾਈ ਹੈ ਜੋ ਕਿ ਪੰਜ ਕਿਲੋਮੀਟਰ ਦਾ ਮੇਰਾ ਟਾਰਗੇਟ ਹੁੰਦਾ ਸੀਗਾ ਜੋ ਮੈਂ ਲੰਮਾ ਦੌੜ ਕੇ ਉਹਨੂੰ ਅਚੀਬ ਵੀ ਕੀਤਾ ਹੈਗਾ